ਅਲੱਗ ਅਲੱਗ ਲੋਕਾਂ ਦੇ ਅਲੱਗ ਅਲੱਗ ਧਰਮ ਹਨ ਸਭ ਧਰਮਾਂ ਦੇ ਆਪਣੇ ਇਤਿਹਾਸ ਹੈ ਅਸੀਂ ਆਪਣਾ ਰੋਜ਼ਾਨਾ ਜੀਵਨ ਕਿਵੇਂ ਬਤੀਤ ਕਰਨਾ ਹੈ ਇਹ ਅਸੀਂ ਆਪਣੇ ਧਰਮ ਤੋਂ ਸਿੱਖਦੇ ਹਾਂ ਧਰਮ ਸਾਨੂੰ ਇੱਕ ਦੂਜੇ ਦਾ ਸਤਿਕਾਰ ਕਰਨਾ ਸਿਖਾਉਂਦਾ ਹੈ ਇਸ ਨਾਲ ਭਾਈਚਾਰੇ ਦੀ ਸਾਂਝ ਵੱਧਦੀ ਹੈ ਅਤੇ ਸਾਨੂੰ ਇੱਕ ਸਾਰੇ ਧਰਮਾਂ ਦਾ ਆਦਰ ਕਰਨਾ ਚਾਹੀਦਾ ਹੈ